ਰੋਜ਼ਾਨਾ ਅਖਬਾਰਾਂ ਸੋਸ਼ਲ ਮੀਡੀਆ ਨਿਊਜ ਚੈਨਲਾਂ ਅਤੇ ਹੋਰ ਸੰਚਾਰ ਸਾਧਨਾਂ ਉੱਪਰ ਅਸੀਂ ਆਮ ਤੌਰ 'ਤੇ ਸੜਕ ਹਾਦਸਿਆਂ ਦੀਆਂ ਭਿਆਨਕ ਤਸਵੀਰਾਂ ਅਤੇ ਖਬਰਾਂ ਦੇਖਦੇ ਅਤੇ ਸੁਣਦੇ ਹਾਂ ਜੋ ਪੜ੍ਹਨ ਅਤੇ ਦੇਖਣ ਵਾਲੇ ਨੂੰ ਦੁਖੀ ਅਤੇ ਪਰੇਸ਼ਾਨ ਕਰਦੀਆਂ ਹਨ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜੇ ਸਾਡੇ ਸਮਾਜ ਲਈ ਬਹੁਤ ਵੱਡੀ ਚਿੰਤਾ ਦਾ ਮਾਮਲਾ ਹੈ ਇਸ ਗੈਰ ਕੁਦਰਤੀ ਘਟਨਾ ਦਾ ਸ਼ਿਕਾਰ ਕੋਈ ਵੀ ਕਿਸੇ ਸਮੇਂ ਵੀ ਹੋ ਸਕਦਾ ਹੈ ਜਿਸ ਨਾਲ ਅਸੀਂ ਹਰ ਸਾਲ ਲੱਖਾਂ ਕੀਮਤਾਂ ਜਾਨਾਂ ਸੜਕਾਂ ਉੱਪਰ ਗਵਾ ਦਿੰਦੇ ਹਾਂ ਕਈ ਭਿਆਨਕ ਸੜਕ ਹਾਦਸਿਆਂ ਵਿੱਚ ਪੂਰੇ ਦੇ ਪੂਰੇ ਪਰਿਵਾਰ ਵੀ ਖਤਮ ਹੋ ਜਾਂਦੇ ਹਨ ਸੰਸਾਰ ਸਿਹਤ ਸੰਸਥਾ ਵੱਲੋਂ ਸਾਰੀ ਸੜਕ ਸੁਰੱਖਿਆ ਸੰਬੰਧੀ ਆਲਮੀ ਸਥਿਤੀ ਰਿਪੋਰਟ ਦੋ ਹਜ਼ਾਰ ਅਠਾਰ੍ਹਾਂ ਅਨੁਸਾਰ ਦੁਨੀਆ ਵਿੱਚ ਹਰ ਸਾਲ ਤੇਰ੍ਹਾਂ ਪੁਆਇੰਟ ਪੰਜ ਕਰੋੜ ਲੋਕ ਸੜਕ ਦੁਰਘਟਨਾਵਾਂ ਵਿੱਚ ਮਾਰੇ ਜਾਂਦੇ ਹਨ ਇਸ ਦਾ ਗੰਭੀਰ ਅਸਰ ਦੇਸ਼ ਦੀ ਅਰਥਵਿਵਸਥਾ ਮਨੁੱਖੀ ਪੂੰਜੀ ਪੀੜ੍ਹਤ ਪਰਿਵਾਰ ਅਤੇ ਸਮਾਜ ਉੱਪਰ ਲੰਬੇ ਸਮੇਂ ਲਈ ਪੈਂਦਾ ਹੈ ਰਿਪੋਰਟ ਮੁਤਾਬਕ ਵੱਧ ਆਮਦਨ ਵਾਲੇ ਦੇਸ਼ ਜਿਨ੍ਹਾਂ ਨੂੰ ਵਿਕਸਿਤ ਮੁਲਕ ਕਿਹਾ ਜਾਂਦਾ ਹੈ ਦੇ ਮੁਕਾਬਲੇ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਸੜਕ ਦੁੜਘ ਦੁਰਘਟਨਾਵਾਂ ਜ਼ਿਆਦਾ ਹੁੰਦੀਆਂ ਹਨ ਜੇ ਭਾਰਤ ਦੀ ਗੱਲ ਕਰੀਏ ਤਾਂ ਦੁਨੀਆਂ 'ਤੇ ਸੜਕ ਸੰਬੰਧੀ ਅੰਕੜੇ ਦੋ ਹਜ਼ਾਰ ਅਠਾਰ੍ਹਾਂ ਅਨੁਸਾਰ ਭਾਰਤ ਦੁਨੀਆ ਦੇ ਇੱਕ ਸੌ ਨੜਿਨਵੇਂ ਦੇਸ਼ਾਂ ਵਿੱਚੋਂ ਸੜਕ ਦੁਰਘਟਨਾਵਾਂ ਵਿੱਚ ਪਹਿਲੇ ਸਥਾਨ ਉੱਪਰ ਹੈ ਜੋ ਦੁਨੀਆ ਵਿੱਚ ਸੜਕ ਹਾਦਸਿਆਂ ਵਿੱਚ ਮਰਨ ਵਾਲੇ ਲੋਕਾਂ ਦਾ ਕਰੀਬ ਗਿਆਰ੍ਹਾਂ ਫੀਸਦੀ ਹਿੱਸਾ ਪਾਉਂਦਾ ਹੈ ਜੇ ਜੇ ਭਾਰਤ ਵਿੱਚ ਸੜਕ ਦੁਰਘਟਨਾਵਾਂ ਦੀ ਸਥਿਤੀ ਨੂੰ ਦੇਖਿਆ ਜਾਵੇ ਤਾਂ ਇਸ ਰਿਪੋਰਟ ਅਨੁਸਾਰ ਦੇਸ਼ ਵਿੱਚ ਦੇਸ਼ ਵਿੱਚ ਪੋਣ ਮ ਦੇਸ਼ ਵਿੱਚ ਪੌਣੇ ਪੰਜ ਲੱਖ ਦੇ ਕਰੀਬ ਸੜਕ ਦੁਰਘਟਨਾਵਾਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਕਰੀਬ ਡੇਢ ਲੱਖ ਲੋਕ ਮਾਰੇ ਗਏ ਹਨ ਇਹ ਅੰਕੜਾ ਜਿਸ ਇਸ ਤੋਂ ਪਿਛਲੇ ਸਾਲ ਦੋ ਹਜ਼ਾਰ ਸਤਾਰ੍ਹਾਂ ਨਾਲੋਂ ਵੀ ਵੱਧ ਦਰਜ ਕੀਤਾ ਗਿਆ ਹੈ ਪੰਜਾਬ ਵਿੱਚ ਸੜਕ ਦੁਰਘਟਨਾਵਾਂ ਦਾ ਸਭ ਤੋਂ ਵੱਡਾ ਕਾਰਨ ਤੇਜ਼ ਰਫਤਾਰ ਏ ਹੈ ਜੋ ਕਿ ਸਭ ਤੋਂ ਸਭ ਤੋਂ ਵੱਧ ਮੌਤਾਂ ਦਾ ਵੀ ਕਾਰਨ ਹੈ ਹੋਰ ਕਾਰਨ ਸ਼ਰਾਬ ਪੀ ਕੇ ਡਰਾਈਵਿੰਗ ਅਵਾਰਾ ਪਸ਼ੂਆਂ ਦਾ ਟਰ ਟਕਰਾਉਣਾ ਸੀਟ ਬੈਲਟ ਅਤੇ ਹੈਲਮੇਟ ਨਾ ਵਰਤਣਾ ਅਤੇ ਸੜਕ ਨਿਯਮਾਂ ਦੀ ਉਲੰਘਣਾ ਕਰਨਾ ਵੀ ਹੈ